ਉੱਨੀ ਜਨਵਰੀ ਦੋ ਹਜ਼ਾਰ ਚੌਬੀ ਤਿੰਨ ਅਕਤੂਬਰ ਦੋ ਹਜ਼ਾਰ ਪੰਜ ਅੱਠ ਅਕਤੂਬਰ ਦੋ ਹਜ਼ਾਰ ਸੋਲ੍ਹਾਂ ਪੰਦਰ੍ਹਾਂ ਅਗਸਤ ਉੱਨੀ ਸੌ ਸੰਤਾਲੀ ਛੇ ਅਕਤੂਬਰ ਉੱਨੀ ਸੌ ਉਣੱਤਰ